ਅੱਜ ਕੱਲ੍ਹ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਹੀ ਟਰੈਂਡ ਵਾ ਜਿਹੜੇ ਲੋਕ ਆ ਜਿਨ ਉਹ ਕੀ ਕਰਦੇ ਆ ਆਪਣੀਆਂ ਜੋ ਕਲਾਂ ਹੁੰਦੀਆਂ ਜਾਂ ਫਿਰ ਜੋ ਵੀ ਉਹਨਾਂ ਕੋਲ ਟੈਲੈਂਟ ਹੁੰਦਾ ਹੈ ਉਹਨੂੰ ਕੀ ਕਰਦੇ ਆ ਇੱਕ ਵੀਡੀਓ ਦੇ ਤੌਰ 'ਤੇ ਕੀ ਕਰਦੇ ਆ ਸੋਸ਼ਲ ਮੀਡੀਆ 'ਤੇ ਅਪਲੋਡ ਕਰਦੇ ਆ ਇਸ ਤਰ੍ਹਾਂ ਕੀ ਹੁੰਦਾ ਹੈ ਕਿ ਉਹਨਾਂ ਦੀ ਮਸ਼ਹੂਰੀ ਹੁੰਦੀ ਆ ਅਤੇ ਉਹਨਾਂ ਨੂੰ ਕਿਤੇ ਨਾ ਕਿਤੇ ਕਾਫ਼ੀ ਮਦਦ ਵੀ ਮਿਲਦੀ ਆ ਸੋ ਸੋਸ਼ਲ ਮੀਡੀਆ ਨੇ ਕੀ ਕੀਤਾ ਵਾ ਅਜਿਹੇ ਲੋਕਾਂ ਨੂੰ ਕੀ ਕੀਤਾ ਇੱਕ ਪਲੈਟਫਾਰਮ ਦਿੱਤਾ ਹੈ ਜਿਹਦੇ ਵਿੱਚ ਉਹ ਕੀ ਕਰ ਸਕਣ ਕਿ ਆਪਣੀ ਜੋ ਕਲਾ ਵਾ ਉਹਦਾ ਵਧੀਆ ਵਧੀਆ ਪ੍ਰਦਰਸ਼ਨ ਕਰ ਸਕਣ ਅਤੇ ਕਿਤੇ ਨਾ ਕਿਤੇ ਜਿਸ ਤਰ੍ਹਾਂ ਉਹਨਾਂ ਦੇ ਅੱਗੇ ਅੱਗੇ ਵਿਊਅਰ ਸਬਸਕ੍ਰਾਈਬਰ ਵੱਧਦੇ ਆ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਇਹਦੇ ਵਿੱਚ ਮਦਦ ਵੀ ਮਿਲਦੀ ਹੈ ਇਸ ਤੋ ਇਲਾਵਾ ਯੂਟਿਊਬ 'ਤੇ ਕਈ ਆਰਟ ਐਂਡ ਕ੍ਰਾਫਟ ਦੇ ਚੈਨਲ ਬਣੇ ਹੋਏ ਆ ਇਹਦਾ ਇਹ ਫ਼ਾਇਦਾ ਹੁੰਦਾ ਹੈ ਕਿ ਜੋ ਬੱਚੇ ਜਾਂ ਫਿਰ ਜਿਹੜੇ ਬੰਦੇ ਆਪਣੇ ਆਰਟ ਐਂਡ ਕ੍ਰਾਫਟ ਸਿੱਖਣ ਦੇ ਵਿੱਚ ਰੁਚੀ ਰੱਖਦੇ ਆ ਪਰ ਉਹ ਕਲਾਸਿਸ ਵਗੈਰਾ ਅਟੈਂਡ ਨਹੀਂ ਕਰ ਸਕਦੇ ਉਹ ਘਰ ਬੈਠੇ ਯੂਟੀਊਬ ਚੈਨਲਸ 'ਤੇ ਤੋਂ ਕੀ ਕਰ ਸਕਦੇ ਆ ਉਹ ਚੀਜ਼ਾਂ ਸਿੱਖ ਸਕਦੇ ਆ ਅਤੇ ਆਪਣੇ ਟੈਲੈਂਟ ਨੂੰ ਹੋਰ ਤਰਾਸ਼ ਸਕਦੇ ਹੈ ਇਸ ਤੋਂ ਇਲਾਵਾ ਕੀ ਹੁੰਦਾ ਹੈ ਕਿ ਜੋ ਵੀ ਉਹਨਾਂ ਨੇ ਸਿੱਖਣਾ ਹੁੰਦਾ ਹੈ ਅੱਜ ਕੱਲ੍ਹ ਹਰ ਇੱਕ ਜਾਣੇ ਨੂੰ ਉਹ ਔਨਲਾਈਨ ਹੀ ਮਿਲ ਜਾਂਦਾ ਹੈ ਯੂਟਿਊਬ ਜਾਂ ਫਿਰ ਸੋਸ਼ਲ ਮੀਡੀਆ ਨੇ ਕੀ ਕੀਤਾ ਇਹ ਬਹੁਤ ਹੀ ਵਧੀਆ ਪਲੇਟਫਾਰਮ ਦਿੱਤਾ ਹੈ ਲੋਕਾਂ ਨੂੰ ਜਿਹਦੇ ਵਿੱਚ ਕੀ ਕਰਦੇ ਉਹ ਆਪਣੀ ਕਲਾ ਨੂੰ ਹੋਰ ਜਿਹੜਾ ਵਾ ਉਹ ਨਿਖਾਰਦੇ ਆ ਜਾਂ ਫਿਰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਆ ਲੋਕ ਵੀ ਉਹਨਾਂ ਨੂੰ ਬਹੁਤ ਪਸੰਦ ਕਰਦੇ ਆ ਅਤੇ ਉਹਨਾਂ ਤੋਂ ਜਿਹੜਾ ਵਾ ਉਹ ਜਿਹੜੀ ਕਲਾ ਵਾ ਉਹ ਵੀਡੀਓਜ ਤੋਂ ਹੀ ਸਿੱਖਦੇ ਆ ਸੋ ਇਸ ਕਰਕੇ ਸੋਸ਼ਲ ਮੀਡੀਆ ਇੱਕ ਬਹੁਤ ਹੀ ਵਧੀਆ ਪਲੇਟਫਾਰਮ ਆ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਆਪਣੀ ਕਲਾ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਹੈ